ਮੈਂ ਨਾ ਐੱਲ ਜੀ ਦੀ ਐਟੋਮੈਟਿਕ ਵੋਸ਼ਿੰਗ ਮਸ਼ੀਨ ਲਿੱਤੀ ਹੈ ਮੇਰੇ ਰਿਸ਼ਤੇਦਾਰਾਂ ਨੇ ਵੀ ਲਿੱਤੀ ਹੈ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਵਧੀਆ ਹੈਗੀ ਹੈ ਅਤੇ ਲੈਣੀ ਹੋਏ ਅਤੇ ਜੇ ਲੈਣੀ ਹੈ ਤਾਂ ਐੱਲ ਜੀ ਦੀ ਲਓ ਫਿਰ ਮੈਂ ਗੂਗਲ 'ਤੇ ਵੀ ਇਹਦੀ ਰੇਟਿੰਗ ਚੈੱਕ ਕੀਤੀ ਅਤੇ ਬੈਸਟ ਹੈਗੀ ਸੀ ਅਤੇ ਸਾਰੇ ਫਿਰ ਮੈਂ ਮਸ਼ੀਨ ਲਿਆਂਦੀ ਐਟੋਮੈਟਿਕ ਅਤੇ ਯੂਜ ਕੀਤੀ ਔਰ ਮੈਨੂੰ ਬਹੁਤ ਵਧੀਆ ਲੱਗਾ ਅਤੇ ਬੱਤੀ ਬੁੱਤੀ ਵੀ ਘੱਟ ਖਿੱਚਦੀ ਆ ਪਾਣੀ ਪਾਣੀ ਵੀ ਆਪਣੇ ਆਪ ਬਦਲਿਆ ਜਾਂਦਾ ਵਾ ਇਸ ਲਈ ਮੈਨੂੰ ਬਹੁਤ ਵਧੀਆ ਲੱਗੀ ਔਨਲਾਈਨ ਮੰਗਾਈ ਆ ਵਧੀਆ ਮੈਨੂੰ ਘਰ ਡਿਲੀਵਰ ਕਰ ਗਏ ਕੋਈ ਇਹੋ ਜਿਹੀ ਪਰੇਸ਼ਾਨੀ ਨਹੀਂ ਹੋਈ ਪ੍ਰੋਡਕਟ ਬਹੁਤ ਵਧੀਆ ਹੈਗਾ ਵਾ ਅਤੇ ਵਰੰਟੀ ਵੀ ਉਹਨਾਂ ਨੇ ਵਧੀਆ ਦਿੱਤੀ ਦਸ ਸਾਲ ਦੀ ਵਰੰਟੀ ਆ ਵਧੀਆ ਲੱਗਾ ਮੈਨੂੰ ਓ ਇਹ ਪਾ ਪਾਣੀ ਦੀ ਵੀ ਘੱਟ ਗਿਆ ਬੱਤੀ ਵੀ ਘੱਟ ਗਈ ਖਰਚਾ ਘੱਟ ਗਿਆ ਅਤੇ ਸ ਇਹਦੇ 'ਚ ਸਪਿੰਨ ਵਾਲਾ ਵੀ ਵਧੀਆ ਨੇ ਜੇ ਮੈਂ ਤਾਂ ਇਹੋ ਗਾਈਡ ਕਰਾਂਗਾ ਜੇ ਲੈਣੀ ਤਾਂ ਐੱਲ ਜੀ ਦੀ ਲੈਣੀ ਚਾਹੀਦੀ ਬੈਸਟ ਹੈਗੀ ਹਾਂਜੀ ਪ੍ਰੋਡਕਟ ਵਧੀਆ ਹੈਗਾ ਵਾ ਕੋਈ ਇਹਦੇ 'ਚ ਕੋਈ ਇਹੋ ਜਿਹਾ ਨੈਗਟਿਵ ਥੋਟ ਨਹੀਂ ਹੈਗਾ ਸਾਰੇ ਬੈਸਟ ਹੈਗਾ ਹਾਂਜੀ ਸਪਿੰਨ ਵਾਲਾ ਵੀ ਵਧੀਆ ਸਭ ਕੁਛ ਠੀਕ ਹੈਗਾ ਮੈਨੂੰ ਤਾਂ ਬਹੁਤ ਵਧੀਆ ਲੱਗੀ ਆ ਅਤੇ ਮੈਂ ਤਾਂ ਇਹੋ ਸੂਜੈਸ਼ ਕਰਾਂਗਾ ਸਾਰਿਆਂ ਨੂੰ ਜੇ ਲੈਣੀ ਤਾਂ ਵਰਕੁਲ ਦੀ ਲਓ ਔਨਲਾਈਨ ਵੀ ਲਓ ਔਨਲਾਈਨ ਪ੍ਰੋਡਕਟ ਵਧੀਆ ਹੁੰਦੇ ਨੇ ਇਹੋ ਜਿਹੀ ਕੋਈ ਗੱਲ ਨੀ ਮੈਂ ਵੀ ਔਨਲਾਈਨ ਲਿੱਤਾ ਨਾ ਮੈਨੂੰ ਪ੍ਰੋਡਕਟ ਬਹੁਤ ਵਧੀਆ ਲੱਗਾ ਅਤੇ ਬਤ ਹਾਂਜੀ ਹਾਂਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ